ਫੋਨ ਖਰੀਦਦੇ ਸਮੇਂ ਕੁਛ ਗੱਲਾਂ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਨੇ ਤਾਂ ਕਿ ਅਸੀਂ ਸਹੀ ਫੋਨ ਚੁਣ ਸਕੀਏ ਸਭ ਤੋਂ ਪਹਿਲੀ ਚੀਜ਼ ਹੈ ਪੈਸਾ ਤੁਸੀਂ ਨਵਾਂ ਫੋਨ ਲੈਣ 'ਤੇ ਕਿੰਨਾ ਖਰਚ ਕਰਨਾ ਚਾਹੁੰਦੇ ਹੋ ਇਹ ਸਾਨੂੰ ਬਿਹਤਰ ਵਿਕਲਪ ਵੱਲ ਜਾਣ ਵਿੱਚ ਮਦਦ ਕਰਦਾ ਹੈ ਅਤੇ ਸਿਰਫ਼ ਪੈਸੇ ਵੱਲ ਹੀ ਨਹੀਂ ਦੇਖਣਾ ਚਾਹੀਦਾ ਉਸ ਮੁੱਲ ਦੇ ਮੁਤਾਬਕ ਫੋਨ ਵਿੱਚ ਕੀ ਕੀ ਗੁਣ ਹਨ ਉਹਦੇ 'ਤੇ ਵੱਧ ਜ਼ੋਰ ਦੇਣਾ ਚਾਹੀਦਾ ਹੈ ਸਕਰੀਨ ਦੇ ਆਕਾਰ ਨੂੰ ਵੀ ਬਹੁਤ ਸੋਚ ਸਮਝ ਕੇ ਖਰੀਦਣਾ ਚਾਹੀਦਾ ਹੈ ਛੋਟੇ ਸਕਰੀਨ ਜ਼ਿਆਦਾਤਰ ਵਧੀਆ ਸਾਬਤ ਹੁੰਦੇ ਹਨ ਫੋਨ ਦਾ ਦਿਮਾਗ ਜਿਸ ਨੂੰ ਅੰਗਰੇਜ਼ੀ ਵਿੱਚ ਪ੍ਰੋਸੈਸਰ ਵੀ ਕਹਿੰਦੇ ਹਨ ਅਗਰ ਤੁਸੀਂ ਫੋਨ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਇੱਕ ਵਧੀਆ ਪ੍ਰੋਸੈਸਰ ਵਾਲੇ ਫੋਨ ਨੂੰ ਹੀ ਖਰੀਦੋ ਸਟੋਰੇਜ ਜਿੱਥੇ ਤੁਸੀਂ ਆਪਣੀ ਫਾਈਲਜ਼ ਰੱਖਦੇ ਹੋ ਇੱਦਾਂ ਦਾ ਫੋਨ ਚੁਣੋ ਜਿੱਥੇ ਤਸਵੀਰਾਂ ਵੀਡੀਓ ਕਾਗਜ਼ਾ ਰੱਖਣ ਦੀ ਜਗ੍ਹਾ ਜ਼ਿਆਦਾ ਹੋਵੇ ਫਿਰ ਤਸਵੀਰਾਂ ਐਸਾ ਫੋਨ ਦੇਖੋ ਜਿਹਦੇ ਵਿੱਚ ਵਧੀਆ ਕੈਮਰਾ ਸੈਂਸਰ ਅਤੇ ਗੁਣ ਹੋਣ ਤਾਂ ਕਿ ਜੋ ਤੁਹਾਡੀਆਂ ਤਸਵੀਰਾਂ ਹਨ ਉਹ ਬਹੁਤ ਹੀ ਜ਼ਿਆਦਾ ਸੋਹਣੀਆਂ ਆਵੇ ਫੋਨ ਦਾ ਜੀਵਨ ਜਿਹਨੂੰ ਬੈਟਰੀ ਵੀ ਕਹਿੰਦੇ ਹਨ ਇੱਕ ਲੰਬੀ ਬੈਟਰੀ ਲਾਈਫ ਵਾਲਾ ਫੋਨ ਬਹੁਤ ਕੰਮ ਆਉਂਦਾ ਹੈ ਔਰ ਸਹੀ ਸਾਬਿਤ ਹੁੰਦਾ ਹੈ ਇਹ ਸਭ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਸਹੀ ਫੈਸਲਾ ਲੈ ਸਕਦੇ ਹਨ ਅਤੇ ਵਧੀਆ ਫੋਨ ਖਰੀਦ ਸਕਦੇ ਹਨ ਆਨਲਾਈਨ ਅਤੇ ਆਫਲਾਈਨ ਮਾਰਕੀਟ ਵਿੱਚੋਂ ਮੈਂ ਜ਼ਿਆਦਾ ਤਰਜੀਹ ਆਨਲਾਈਨ ਮਾਰਕੀਟ ਨੂੰ ਦਿੰਦੀ ਹਨ ਕਿਉਂਕਿ ਆਨਲਾਈਨ ਮਾਰਕੀਟ ਚੌਵੀ ਘੰਟੇ ਖੁੱਲ੍ਹੇ ਰਹਿੰਦੇ ਹਨ ਖਰੀਦਦਾਰ ਆਪਣੇ ਘਰ ਬੈਠੇ ਆਰਾਮ ਨਾਲ ਕਿਸੇ ਵੀ ਵੇਲੇ ਖਰੀਦਦਾਰੀ ਕਰ ਸਕਦਾ ਹੈ ਇਸ ਲਈ ਆਪਣਾ ਜ਼ਿਆਦਾ ਵਕਤ ਵੀ ਨਹੀਂ ਦੇਣਾ ਪੈਂਦਾ ਖਰੀਦਦਾਰ ਆਨਲਾਈਨ 'ਤੇ ਕੁਛ ਵੀ ਲੱਭ ਸਕਦਾ ਹੈ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਭਲੇ ਕੀ ਉਹ ਉਹਨਾਂ ਦੇ ਸ਼ਹਿਰ ਅਤੇ ਬਾਜ਼ਾਰਾਂ ਵਿੱਚ ਉਪਲਬਧ ਨਾ ਹੋਣ ਖਰੀਦਦਾਰ ਆਨਲਾਈਨ ਜ਼ਿਆਦਾ ਵਧੀਆ ਸੌਦਾ ਲੱਭ ਸਕਦਾ ਹੈ ਇਸ ਲਈ ਮੈਨੂੰ ਆਨਲਾਈਨ ਜ਼ਿਆਦਾ ਵਧੀਆ ਲੱਗਦਾ ਹੈ